ਅੱਜ ਕੱਲ੍ਹ ਦੇ ਸਮੇਂ ਵਿੱਚ ਸਰੀਰਕ ਤਨਾਵ ਇੰਨਾਂ ਕੁ ਵੱਧ ਗਿਆ ਹੈ ਕਿ ਉਹਦੇ ਨਾਲ ਨਾਲ ਸਰੀਰ ਦਾ ਖਿਆਲ ਵੀ ਰੱਖਣਾ ਪੈਂਦਾ ਹੈ ਸਾਨੂੰ ਆਪਣੇ ਸਰੀਰ ਦਾ ਖਿਆਲ ਰੱਖਣ ਲਈ ਪਰਿਵਾਰ ਦੀ ਜ਼ਿੰਮੇਵਾਰੀਆਂ ਤਾਂ ਸੰਭਾਲਣੀਆਂ ਪੈਂਦੀਆਂ ਹੀ ਪੈਂਦੀਆਂ ਸਰੀਰ ਨੂੰ ਸਿਹਤਮੰਦ ਵੀ ਰੱਖਣਾ ਪੈਂਦਾ ਹੈ ਉਹਦੇ ਲਈ ਮੈਂ ਸਾਈਕਲ ਚਲਾਉਣਾ ਬਹੁਤ ਵਧੀਆ ਚੀਜ਼ ਮੰਨਦਾ ਹਾਂ ਕਿਉਂਕਿ ਮੈਂ ਜਦ ਉਹ ਸਵੇਰੇ ਉੱਠਦਾ ਹਾਂ ਤਾਂ ਮੇਰਾ ਸਰੀਰ ਸੁਸਤੀ ਭਰਿਆ ਹੁੰਦਾ ਹੈ ਅਤੇ ਸਰੀਰ ਵਿੱਚ ਐਨਰਜੀ ਬਿਲਕੁਲ ਨਹੀਂ ਹੁੰਦੀ ਸਰੀਰ 'ਚ ਸੁਸਤੀ ਦੂਰ ਕਰਨ ਲਈ ਮੈਂ ਸਵੇਰੇ ਜਦੋਂ ਉੱਠਦਾ ਹਾਂ ਤਾਂ ਸਭ ਤੋਂ ਪਹਿਲਾਂ ਉੱਠਣ ਸਾਰ ਫਰੈਸ਼ ਹੋ ਕੇ ਮੂੰਹ ਧੋ ਕੇ ਬੁਰਸ਼ ਕਰਕੇ ਮੈਂ ਸਭ ਤੋਂ ਪਹਿਲਾਂ ਜੋ ਮੇਰਾ ਕੰਮ ਹੁੰਦਾ ਹੈ ਉਹ ਮੈਂ ਸਵੇਰੇ ਸਵੇਰੇ ਸਾਈਕਲ ਚਲਾਉਂਦਾ ਹਾਂ ਕਿਉਂਕਿ ਮੈਨੂੰ ਭੱਜਣਾ ਪਸੰਦ ਨਹੀਂ ਆ ਦੌੜਨਾ ਪਸੰਦ ਨਹੀਂ ਆ ਕਿਉਂਕਿ ਮੈਂ ਸ਼ੁਰੂ ਤੋਂ ਹੀ ਸਾਈਕਲ ਚਲਾਉਂਦਾ ਆ ਰਿਹਾ ਹਾਂ ਕਿਉਂਕਿ ਇਹ ਮੈਨੂੰ ਖੁਸ਼ੀ ਪ੍ਰਦਾਨ ਕਰਦਾ ਹੈ ਜਦੋਂ ਮੈਂ ਇਸ ਨੂੰ ਚਲਾਉਂਦਾ ਹਾਂ ਤਾਂ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਇਹਦੇ ਨਾਲ ਮੇਰਾ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਵਧੀਆ ਪਿਆਰ ਬਣਿਆ ਹੈ ਮੈਂ ਹੋਰ ਸਭ ਕੁਝ ਛੱਡ ਸਕਦਾ ਹਾਂ ਪਰ ਬਾਈਕਿੰਗ ਚਲਾਉਣਾ ਕਦੇ ਨਹੀਂ ਛੱਡ ਸਕਦਾ ਕਿਉਂਕਿ ਮੈਂ ਬਾਈਕਿੰਗ ਦੇ ਨਾਲ ਨਾਲ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਹੁੰਦੀਆਂ ਨੇ ਮੈਂ ਸਾਈਕਲ ਨੂੰ ਜਦੋਂ ਵੀ ਚਲਾਉਂਦਾ ਹਾਂ ਤਾਂ ਸਾਰਾ ਹੀ ਕੰਮ ਮੈਂ ਆਪਣੇ ਸਾਈਕਲ 'ਤੇ ਕਰਦਾ ਹਾਂ ਕਿਉਂਕਿ ਜਦੋਂ ਸਵੇਰੇ ਮੈਂ ਆਪਣੀ ਸਵੇਰ ਦੀ ਸੈਰ ਇਹਦੇ ਤੋਂ ਸ਼ੁਰੂ ਕਰਦਾ ਹਾਂ ਅਤੇ ਫਿਰ ਘਰਦਿਆਂ ਵਾਸਤੇ ਮੰਡੀ ਤੋਂ ਸਬਜ਼ੀ ਵਗੈਰਾ ਵੀ ਇਸੇ 'ਤੇ ਲੈ ਕੇ ਆਉਂਦਾ ਹਾਂ ਉਸ ਤੋਂ ਬਾਅਦ ਜਦੋਂ ਸਬਜ਼ੀ ਲੈ ਕੇ ਘਰੇ ਆਉਂਦਾ ਹਾਂ ਤਾਂ ਘਰਦੇ ਘਰਦਿਆਂ ਤੋਂ ਰੋਟੀ ਖਾ ਕੇ ਫਿਰ ਵੀ ਜਦੋਂ ਮੈਂ ਆਪਣੇ ਕੰਮ 'ਤੇ ਜਾਂਦਾ ਹਾਂ ਅਤੇ ਨਾਲ ਹੀ ਬਾਈਕਿੰਗ ਨਾਲ ਹੀ ਸਾਈਕਲ ਵੀ ਲੈ ਕੇ ਜਾਂਦਾ ਹਾਂ ਕਿਉਂਕਿ ਹੋਰ ਕਿਸੇ ਚੀਜ਼ ਦਾ ਮੈਨੂੰ ਸ਼ੌਂਕ ਨਹੀਂ ਹੈ ਇਹਨੂੰ ਜ਼ਿਆਦਾਤਰ ਮੈਂ ਨਾਲ ਹੀ ਰੱਖਦਾ ਹਾਂ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਘਰ ਆਈਦਾ ਹੈ ਅਤੇ ਘਰ ਵਾਸਤੇ ਕੋਈ ਵੀ ਸਮਾਨ ਲੈ ਕੇ ਆਉਣਾ ਹੁੰਦਾ ਤਾਂ ਤਾਂ ਵੀ ਮੈਂ ਇਸੇ 'ਤੇ ਹੀ ਲੈ ਕੇ ਆਉਣਾ ਹਾਂ ਇਹ ਮੈਨੂੰ ਬਹੁਤ ਵਧੀਆ ਸਾਧਨ ਲੱਗਦਾ ਹੈ ਅਤੇ ਇਹਦੇ ਨਾਲ ਮੇਰੇ ਸਰੀਰ ਦੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ